ਭਾਰਤ ਵਿੱਚ ਬਹੁਤ ਸਾਰੇ ਉਦਯੋਗਪਤੀ ਵਪਾਰੀ ਅਤੇ ਨੇਤਾ ਨੇ ਜਿਹਨਾਂ ਨੇ ਭਾਰਤ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਬਦਲ ਦਿੱਤਾ ਜਿਵੇਂ ਅੱਜ ਕੱਲ੍ਹ ਟੈਕਨੋਲਜੀ ਵਿੱਚ ਸਭ ਤੋਂ ਜ਼ਿਆਦਾ ਅਹਿਮ ਭੂਮੀ ਕੰਪਿਊਟਰ ਦੀ ਆ ਕੰਪਿਊਟਰ ਵਗਾ ਵਿਗਿਆਨ ਦੀ ਅਦਭੁੱਤ ਖੋਜ ਹੈ ਕੰਪਿਊਟਰ ਟੈਕਨੋਲਜੀ ਦੇ ਵਿਕਾਸ ਦਾ ਇੱਕ ਸਿਖਰ ਹੈ ਕੰਪਿਊਟਰ ਦੇ ਕਾਰ ਕੰਪਿਊਟਰ ਦੇ ਕਾਰਨ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਸੌਖੇ ਹੋ ਗਏ ਨੇਗੇ ਇੰਟਰਨੈ ਇੰਟਰਨੈਟ ਦੇ ਨਾਲ ਸੰਸਾਰ ਦੇ ਕੋਨੇ ਕੋਨੇ ਨੂੰ ਆਪਸ ਵਿੱਚ ਜੋੜ ਦਿੱਤਾ ਇਹ ਵਿਗਿਆਨ ਦੀ ਪ੍ਰਸਿੱਧ ਕਾਢ ਆ ਕੰਪਿਊਟਰ ਅੱਜ ਕੱਲ੍ਹ ਸਾਡੇ ਮਨੋਰੰਜਨ ਦਾ ਸਾਧਨ ਵੀ ਬਣ ਗਿਆ ਜਿਵੇਂ ਅਸੀਂ ਇੰਟਰਨੈਟ ਰਾਹੀਂ ਇੱਕ ਦੂਜੇ ਨਾਲ ਗੱਲਾਂ ਕਰ ਸਕਦੇ ਹਾਂ ਗੇਮਾਂ ਖੇਡ ਸਕਦੇ ਹਾਂ ਅਤੇ ਔਨਲਾਈਨ ਬਹੁਤ ਸਾਰੇ ਵਪਾਰ ਵੀ ਕਰ ਸਕਦੇ ਹਾਂ ਟੈਕਨੋਲਜੀ ਨੇ ਆਵਾਜਾਈ ਦਾ ਕੰਮ ਵੀ ਸੌਖਾ ਕਰ ਦਿੱਤਾ ਹੈ ਜਿਵੇਂ ਅਸੀਂ ਟਿਕਟਾਂ ਬੁੱਕ ਕਰਨੀਆਂ ਹੋਣ ਜਾਂ ਕੈਂਸਲ ਕਰਨੀਆਂ ਹੋਣ ਇਹ ਸਾਰਾ ਕੁਝ ਇੰਟਰਨੈਟ 'ਤੇ ਹੋ ਜਾਂਦਾ ਟੈਕਨੋਲਜੀ ਨੇ ਹੋਰ ਵੀ ਬਹੁਤ ਸਾਰੇ ਬਦਲਾਅ ਕੀਤੇ ਨੇ ਜਿਵੇਂ ਅਸੀਂ ਕਿਤੇ ਜਾਣਾ ਹੋਵੇ ਪਰ ਸਾਨੂੰ ਰਸਤਾ ਨਾ ਪਤਾ ਹੋਵੇ ਤਾਂ ਅਸੀਂ ਲੋਕੇਸ਼ਨ 'ਚ ਜਾ ਕੇ ਰਸਤਾ ਲੱਭ ਸਕਦੇ ਹਾਂ ਟੈਕਨੋਲਜੀ ਨੇ ਸਿੱਖਿਆ ਵਿੱਚ ਵੀ ਬਹੁਤ ਵਾਧਾ ਕੀਤਾ ਹੈ ਜਿਵੇਂ ਪਹਿਲਾਂ ਪੜ੍ਹਨ ਲਈ ਬਹੁਤ ਸਾਰੀਆਂ ਕਿਤਾਬਾਂ ਚਾਹੀਦੀਆਂ ਹੁੰਦੀਆਂ ਸੀ ਪਰ ਅੱਜ ਕੱਲ੍ਹ ਅਸੀਂ ਹਰ ਇੱਕ ਪ੍ਰਸ਼ਨ ਦਾ ਉੱਤਰ ਆ ਜਿਹੜਾ ਇੰਟਰਨੈਟ 'ਤੇ ਲੱਭ ਸਕਦੇ ਆਂ ਇਸ ਤਰ੍ਹਾਂ ਜਿਹੜੇ ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਤਬਦੀਲੀਆਂ ਲਿਆਉਂਦੀਆਂ ਨੇ